ਸ਼ਹਿਰਾਂ ਵਿੱਚ ਤਾਂ ਇਹ ਚੀਜ਼ ਮਿਲ ਜਾਂਦੀ ਹੈ ਘਾਟ ਤਾਂ ਕੋਈ ਨਹੀਂ ਹੈ ਖਰਚਾ ਵੱਧ ਗਿਆ ਹੈ ਕਿਸੇ ਚੀਜ਼ ਦਾ ਡਬਲ ਮੁੱਲ ਮੰਗ ਲੈਂਦੇ ਹਨ ਬਾਕੀ ਜੋ ਪਿਛੜੇ ਇਲਾਕੇ ਹਨ ਉਨ੍ਹਾਂ ਦੇ ਵਿੱਚ ਇਹ ਘਾਟ ਹੈਗੀ ਹੈ ਨਾ ਉੱਥੇ ਪੜ੍ਹੇ ਲਿਖੇ ਲੋਕ ਨੇ ਜੋ ਪੜ੍ਹ ਲਿਖ ਜਾਂਦਾ ਉਹ ਬਾਹਰ ਨੂੰ ਨਿਕਲ ਜਾਂਦਾ ਉੱਥੇ ਫੇਰ ਘੱਟ ਪੜ੍ਹੇ ਲਿਖੇ ਲੋਕ ਰਹਿ ਜਾਂਦੇ ਹਨ ਕਿਤੇ ਕਿਤੇ ਟੀਕਾਕਰਨ ਕੇਂਦਰ ਹਨ ਕਿਤੇ ਕਿਤੇ ਬੰਦ ਹੋ ਗਏ ਹਨ ਲੋਕ ਬਹੁਤ ਜ਼ਿਆਦਾ ਨਹੀਂ ਪੜ੍ਹੇ ਲਿਖੇ ਹੈਗੇ ਜਿਹਦੇ ਕਰਕੇ ਉਹਨਾਂ ਨੂੰ ਇਹ ਸਮੱਸਿਆ ਦੇਖਣੀ ਪੈਂਦੀ ਹੈ ਸਾਡੇ ਇਲਾਕੇ 'ਚ ਇਹ ਚੀਜ਼ ਠੀਕ ਹੈ ਤੁਹਾਨੂੰ ਦੱਸਿਆ ਹੋਸਪਿਟਲ ਨੇ ਪ੍ਰਾਈਵੇਟ ਨੇ ਸਰਕਾਰੀ ਨੇ ਉੱਥੇ ਜਾਉ ਉੱਥੇ ਤੁਹਾਨੂੰ ਇਹ ਚੀਜ਼ਾਂ ਮਿਲ ਜਾਂਦੀਆਂ ਹਨ